ਡਿਜ਼ੀਟਲ ਸਾਖਰਤਾ ਟੈਕਨੋਲਜੀ ਸਿੱਖਿਆ ਲੋਕਾਂ ਨੂੰ ਸਿੱਖਿਅਤ ਢੰਗ ਨਾਲ ਇੰਟਰਨੈੱਟ ਨੈਵੀਗੇਸ਼ਨ ਕਰਨ ਔਨਲਾਈਨ ਗੋਪਨੀਅਤਾ ਨੂੰ ਸਮਝਣ ਅਤੇ ਗਲਤ ਜਾਣਕਾਰੀ ਦੀ ਪਛਾਣ ਕਰਨ ਵਿੱਚ ਮਦਦ ਕਰਦੀ ਹੈ ਇਹ ਉਸ ਸੰਸਾਰ ਵਿੱਚ ਬਹੁਤ ਜ਼ਰੂਰੀ ਹੈ ਜਿੱਥੇ ਸਾਡੀ ਜ਼ਿਆਦਾਤਰ ਜਾਣਕਾਰੀ ਅਤੇ ਪਰਸਪਰ ਪ੍ਰਭਾਵ ਡਿਜ਼ੀਟਲ ਹਨ ਧੰਨਵਾਦ